ਹਾਂ ਸਾਡੇ ਘਰ ਦੇ ਨਾਲ ਹੀ ਕਲਾ ਸਪਲਾਈ ਸਟੋਰ ਹੈ ਜਿੱਥੋਂ ਮੈਨੂੰ ਬਹੁਤ ਸਮਾਨ ਮਿਲ ਜਾਂਦਾ ਕਲਾ ਕਲਾ ਬਣਾਉਣ ਲਈ ਜਿਵੇਂ ਕਿ ਰੰਗੀਨ ਪੇਪਰ ਸਕੈਚ ਪੇਂਟਿੰਗ ਰੰਗ ਬੁਰਸ਼ ਆਦਿ ਖਰੀਦ ਕੇ ਲੈ ਕੇ ਆਉਂਦੀ ਹਾਂ ਮੈਂ ਆਪਣੇ ਸੂਟਾਂ 'ਤੇ ਰੰਗਾਂ ਦੀ ਵਰਤੋਂ ਨਾਲ ਅਲੱਗ ਅਲੱਗ ਡਿਜ਼ਾਇਨ ਬਣਾ ਕੇ ਪੇਟਿੰਗ ਪੇਂਟਿੰਗ ਕਰਦੀ ਹਾਂ ਮੇਰਾ ਮੁੱਖ ਕਿੱਤਾ ਹੀ ਸੂਟਾਂ 'ਤੇ ਪੇਟਿੰਗ ਕਰ ਪੇਂਟਿੰਗ ਕਰ ਕੇ ਅੱਗੇ ਵੇਚਣਾ ਹੈ ਮੈਂ ਬਹੁਤ ਸਾਰੇ ਲੋਕਾਂ ਨੂੰ ਸੂਟ ਅਤੇ ਪੰਜਾਬੀ ਜੁੱਤੀਆਂ ਪੇਂਟਿੰਗ ਕਰਕੇ ਦਿੱਤੀਆਂ ਹਨ ਉਹ ਡਿਜ਼ਾਇਨ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਹਨ ਅਤੇ ਖਰੀਦਦੇ ਵੀ ਹਨ ਮੈਂ ਪੇਂਟਿੰਗ ਦੇ ਡਿਜ਼ਾਇਨ ਜ਼ਿਆਦਾਤਰ ਸ਼ੋਸ਼ਲ ਮੀਡੀਆ ਤੋਂ ਹੀ ਵੇਖ ਕੇ ਤਿਆਰ ਕਰਦੀ ਹਾਂ ਜਿੱਥੇ ਕਿ ਬਹੁਤ ਹੀ ਤਰ੍ਹਾਂ ਦੇ ਵਧੀਆ ਵਧੀਆ ਡਿਜ਼ਾਇਨ ਮੈਨੂੰ ਮਿਲ ਜਾਂਦੇ ਹਨ ਹਨ ਇਹ ਡਿਜ਼ਾਇਨ ਬਣਾਉਣ ਲਈ ਮੈਂ ਬੁਰਸ਼ ਪੇਂਟਿੰਗ ਰੰਗਾਂ ਆਦਿ ਦੀ ਵਰਤੋਂ ਕਰਦੀ ਹਾਂ ਇਸ ਦੇ ਨਾਲ ਮੈਂ ਸੂਟਾਂ 'ਤੇ ਕਢਾਈ ਦੇ ਰੰਗਾਂ ਦੀ ਵਰਤੋਂ ਕਰਦੀ ਹਾਂ ਜਿਨ੍ਹਾਂ ਨਾਲ ਕਢਾਈ ਕੀਤੀ ਜਾਂਦੀ ਹੈ